ਜੀ ਹਾਂਜੀ ਮੈਂ ਡੇਲੀ ਪ੍ਰਣਾਯਾਮ ਕਰਦਾ ਹਾਂ ਜਿਸ ਕਰਕੇ ਕੁਛ ਸਮੇਂ ਪਹਿਲਾਂ ਮੈਨੂੰ ਸਾਹ ਲੈਣ ਦੀ ਪ੍ਰੋਬਲਮ ਹੋ ਰਹੀ ਸੀ ਅਤੇ ਇਹਦੇ ਵਿੱਚ ਮੈਨੂੰ ਅਜਾਇਟੀ ਵੀ ਸ਼ੁਰੂ ਹੋ ਗਈ ਸੀ ਮੈਂ ਪ੍ਰਣਾਯਾਮ ਯੋਗਾ ਕਰਕੇ ਇਹ ਆਪਣੀ ਪ੍ਰੋਬਲਮ ਦੂਰ ਕੀਤਾ ਹੈ ਮੈਂ ਡੇਲੀ ਸਵੇਰੇ ਪੰਜ ਵਜੇ ਉੱਠ ਕੇ ਆਪਣਾ ਯੋਗਾ ਮੈਟ ਲੈ ਕੇ ਪ੍ਰਣਾਯਾਮ ਕਰਦਾ ਹਾਂ ਅਤੇ ਲੰਬੇ ਲੰਬੇ ਸਾਹ ਲੈਂਦਾ ਹਾਂ ਜਿਸ ਕਰਕੇ ਮੇਰੇ ਫੇਫੜਿਆਂ ਵਿੱਚ ਠੰਡੀ ਅਤੇ ਤਾਜ਼ੀ ਹਵਾ ਜਾਂਦੀ ਹੈ ਜਿਸ ਕਰਕੇ ਮੇਰੇ ਸਰੀਰ ਵਿੱਚ ਖੂਨ ਦਾ ਬਹਾਵ ਵਧੀਆ ਅਤੇ ਫਰੈਸ਼ ਹੁੰਦਾ ਹੈ ਅਤੇ ਮੇਰਾ ਮਾਇੰਡ ਵੀ ਫਰੈਸ਼ ਹੁੰਦਾ ਹੈ ਅਤੇ ਪ੍ਰਣਾਯਾਮ ਦੇ ਸਾਡੇ ਜ਼ਿੰਦਗੀ ਵਿੱਚ ਕਾਫੀ ਫਾਇਦੇ ਹਨ ਵੈਸੇ ਤਾਂ ਯੋਗਾ ਦੇ ਵੀ ਕਾਫੀ ਫਾਇਦੇ ਹਨ ਯੋਗਾ ਵਿੱਚ ਪ੍ਰਣਾਯਾਮ ਇੱਕ ਵਿਸ਼ੇਸ਼ ਰੋਲ ਅਦਾ ਕਰਦਾ ਹੈ ਤਾਂ ਤਾਂ ਮੈਂ ਸਾਰਿਆਂ ਨੂੰ ਇਹੀ ਕਵਾਂਗਾ ਕਿ ਸਵੇਰੇ ਉੱਠ ਕੇ ਯੋਗ ਕਰੋ ਅਤੇ ਪ੍ਰਣਾਯਾਮ ਤਾਂ ਜ਼ਰੂਰ ਹੀ ਕਰੋ ਧੰਨਵਾਦ